ਕਈ ਸਾਲਾਂ ਤੋਂ ਫੋਟੋਗ੍ਰਾਫੀ ਜਿਹੜੀ ਆ ਉਹ ਬਦਲ ਗਈ ਹੈ ਪਹਿਲਾਂ ਪੁਰਾਣੇ ਕੈਮਰਿਆਂ ਵਿੱਚ ਜਿਹੜੀ ਆ ਫੋਟੋ ਦੀ ਆ ਜਿਹੜੀ ਕੁਆਲਿਟੀ ਆ ਉਹ ਜ਼ਿਆਦਾ ਵਧੀਆ ਨਹੀਂ ਹੁੰਦੀ ਸੀ ਅਤੇ ਹੁਣ ਪਹਿਲਾਂ ਨਾਲੋਂ ਜਿਹੜੇ ਕੈਮਰੇ ਆ ਉਹ ਕਈ ਕਈਆਂ ਕਈਆਂ ਕੋਲ ਹੁੰਦੇ ਸੀ ਕਈ ਉਹਨੂੰ ਨਹੀਂ ਲੈ ਸਕਦੇ ਸੀ ਹਾਈ ਕੋਸਟ ਹੋਣ ਦੀ ਵਜ੍ਹਾ ਨਾਲ ਅਤੇ ਅੱਜ ਕੱਲ੍ਹ ਸਾਰਿਆਂ ਕੋਲ ਮੋਬਾਇਲ ਫੋਨ ਜਿਹੜੇ ਆ ਉਹ ਵੇਲੇਵਲ ਆ ਅਤੇ ਲੋਕ ਜਿਹੜੇ ਆ ਉਹਨਾਂ ਵਿੱਚ ਹੀ ਪਿਕਚਰ ਜਿਹੜੀ ਆ ਉਹ ਕਲਿੱਕ ਕਰ ਪਾਉਂਦੇ ਕਰ ਸਕਦੇ ਆ ਕਿਉਂਕਿ ਉਹਦੀ ਜਿਹੜੀ ਆ ਐਡੀਟਿੰਗ ਜਿਹੜੀ ਕੁਆਲਿਟੀ ਆ ਉਹ ਵੀ ਬੜੀ ਸਹੀ ਹੁੰਦੀ ਹੈ ਮਤਲਬ ਫੋਟੋ ਨੂੰ ਕਿਤੇ ਵੀ ਬੈਠ ਕੇ ਐਡੀਟ ਕਰ ਸਕਦੇ ਆ ਔਰ ਕਿਤੇ ਵੀ ਫੋਟੋ ਜਿਹੜੀ ਆ ਉਹ ਕਲਿਕ ਕਰ ਸਕਦੇ ਹੈ ਫੋਟੋ ਦੀ ਜਿਹੜੀ ਆ ਕੁਆਲਟੀ ਆ ਉਹ ਬਹੁਤ ਹੀ ਵਧੀਆ ਮਿਲਿਆ ਕਰਦੀ ਹੈ ਹੁਣ ਮਤਲਬ ਪਹਿਲਾਂ ਫੋਟੋ ਖਿੱਚਣ ਲਈ ਕੋਈ ਵੀ ਫੰਕਸ਼ਨ 'ਤੇ ਕਿਸੇ ਨੂੰ ਬੁਲਾਉਣਾ ਪੈਂਦਾ ਸੀ ਜਿਹਨਾਂ ਕੋਲ ਕੈਮਰੇ ਹੁੰਦੇ ਸੀ ਪਰ ਹੁਣ ਮਤਲਬ ਆਪਣੇ ਫੋਨ ਤੋਂ ਹੀ ਜਿਹੜੀਆਂ ਉਹ ਫੋਟੋਸ ਕਲਿਕ ਕਰ ਸਕਦੇ ਆ ਉਹਨੂੰ ਈਜ਼ਲੀ ਜਿਹੜੀ ਆ ਉਹ ਕਢਵਾ ਸਕਦੇ ਆ ਮਤਲਬ ਫਰੇਮ ਕਰਵਾ ਸਕਦੇ ਆ ਫੋਟੋ ਨੂੰ ਮੋਬਾਇਲ ਤੋਂ ਹੀ ਮਤਲਬ ਕਾਫੀ ਸਾਰਾ ਜਿਹੜਾ ਉਹ ਬਦਲ ਗਿਆ ਪਹਿਲਾਂ ਜਿਹੜੀਆਂ ਉਹ ਬਲੈਕ ਐਂਡ ਵਾਈਟ 'ਚ ਫੋਟੋਜ਼ ਹੁੰਦੀਆਂ ਸੀ ਪਰ ਅੱਜ ਕੱਲ੍ਹ ਜਿਹੜੇ ਆ ਮੋਬਾਈਲ ਵਿੱਚ ਹੀ ਕਲਰ ਵਿੱਚ ਜਿਹੜੀਆਂ ਉਹ ਫੋਟੋਆਂ ਕਲਿੱਕ ਹੋ ਜਾਂਦੀਆਂ ਔਰ ਹੂੰ ਅਡੀਟਿੰਗ ਹੋ ਜਾਂਦੀਆਂ ਆਰਾਮ ਨਾਲ ਧੰਨਵਾਦ